ਮੌਜੂਦਾ ਰੁਝਾਨਾਂ ਨਾਲ ਜੁੜੇ ਰਹਿਣ ਲਈ ਤੁਸੀਂ ਕਿਹੜੇ ਕਿਹੜੇ ਵੱਖ ਵੱਖ ਫੋਟੋਗ੍ਰਾਫੀ ਪ੍ਰਦਰਸ਼ਨ ਅਤੇ ਗੈਲਰੀਆਂ ਵਿੱਚ ਹਾਜ਼ਰ ਹੁੰਦੇ ਔ ਐਸੇ ਤਾਂ ਐ ਐਮੇ ਤਾਂ ਕੁਛ ਨਹੀਂ ਹੈ ਕਿ ਮੈਂ ਕੋਈ ਗੈਲਰੀ ਮੈਂ ਜਾਂ ਐਕਚੁਲੀ ਇਨ੍ਹਾਂ ਫੋਟੋਗ੍ਰਾਫੀ ਪ੍ਰਦਰਸ਼ਨੀਆਂ ਇੰਨਾਂ ਕੋਈ ਖਾਸ ਮੈਨੂੰ ਇੰਨਾਂ ਜ਼ਿਆਦਾ ਇੱਛੁਕ ਨਹੀਂ ਹੈਗਾ ਪਰ ਹਾਂ ਕਿ ਮੈਂ ਖੁਦ ਫੋਟੋ ਕੈਪਚਰ ਆਪਣੀ ਖਿੱਚਦਾ ਜ਼ਰੂਰ ਹਾਂ ਕਿ ਮੈਂ ਇੰਸਟਾਗ੍ਰਾਮ 'ਤੇ ਜਾਂ ਫੇਸਬੁੱਕ 'ਤੇ ਅਪਲੋਡ ਕਰ ਸਕਾਂ ਜਾਂ ਯੂਟਿਊਬ 'ਤੇ ਕੋਈ ਆਪਣੇ ਚੈਨਲ 'ਤੇ ਕੁਛ ਨਾ ਕੁਛ ਪਾ ਸਕਾਂ ਇਸ ਤੋਂ ਇਲਾਵਾ ਤਾਂ ਮੈਨੂੰ ਇੰਨਾਂ ਫੋਟੋਗ੍ਰਾਫੀ ਦਾ ਜਾਂ ਗੈਲਰੀਆਂ ਵਿਜਿਟ ਕਰਨ ਦਾ ਕੋਈ ਸ਼ੌਂਕ ਨਹੀਂ ਹੈ ਜ਼ਿਆਦਾ ਬੱਟ ਹਾਂ ਫ਼ਿਲਮਾਂ ਵਗੈਰਾ ਦੇ ਵਿੱਚ ਦੇਖਦੇ ਹਾਂ ਫੋਟੋਗ੍ਰਾਫ ਪ੍ਰਦਰਸ਼ਨੀਆਂ ਜਿਹੜੀਆਂ ਲੱਗਦੀਆਂ ਨੇ ਗੈਲਰੀਆਂ ਜਾਂ ਲੱਗਦੀਆਂ ਨੇ ਬਹੁਤ ਤੁਹਾਨੂੰ ਪਤਾ ਮਹਿੰਗੀਆਂ ਮਹਿੰਗੀਆਂ ਜਿਹੜੀ ਫੋਟੋਆਂ ਹੁੰਦੀਆਂ ਨੇ ਉਹ ਜ਼ਰੂਰ ਦੇਖੀ ਦੀਆਂ ਨੇ ਗੈਲਰੀ ਵਗੈਰਾ ਦੇ ਵਿੱਚ ਵੈਸੇ ਕੋਈ ਖਾਸ ਨੋਲੇਜ ਮੈਨੂੰ ਇਨ੍ਹਾਂ ਬਾਰੇ ਤਾਂ ਇਹ ਨਹੀਂ ਹੈ ਕਿ ਜੋ ਮੈਂ ਤੁਹਾਡੇ ਨਾਲ ਉਰੇ ਸਾਂਝੀ ਕਰ ਸਕਾਂ ਤਾਂ ਬਸ ਆਹੀ ਸੀ ਮੇਰੇ ਵੱਲੋਂ ਹੋਰ ਤਾਂ ਕੁਛ ਜ਼ਿਆਦਾ ਮੈਨੂੰ ਬੋਲ ਨਹੀਂ ਸਕਦਾ ਇਸ ਬਾਰੇ 'ਚ